ਜਿਵੇਂ ਕਿ ਮੈਨੂੰ ਘਰ ਦਾ ਕੰਮ ਦੇ ਵਿੱਚ ਨਾਲ ਨਾਲ ਮੈਂ ਮਤਲਬ ਵੀ ਦਾ ਕੰਮ ਕਰਦੀ ਹਾਂ ਅਤੇ ਮੈਨੂੰ ਸ਼ੁਰੂ ਤੋਂ ਸ਼ੌਂਕ ਸੀਗਾ ਮੈਂ ਬੁਣਾਈ ਦਾ ਕੰਮ ਕਰਾਂ ਕੋਟੀਆਂ ਸਵਾਟਰ ਸਵੈਟਰ ਮਤਲਬ ਜੋ ਵੀ ਹੈ ਘਰ ਵਿੱਚ ਬੱਚਿਆਂ ਦੇ ਕੋਟੀਆਂ ਅਤੇ ਸੈਟ ਟੋਪੀ ਵਾਲੇ ਸੈਟ ਅਤੇ ਸਵਾਟਰ ਜੈਂਟਸ ਕੋਟੀਆਂ ਲੈਡੀਜ਼ ਸਵੈ ਜੈਕਟਾਂ ਦਾ ਘਰ ਆ ਇਹ ਬੁਣਨੀਆਂ ਜੁਰਾਬਾਂ ਬੁਣਨੀਆਂ ਇਹ ਮੈਨੂੰ ਮਤਲਬ ਵੀ ਬਹੁਤ ਵਧੀਆ ਲੱਗਦਾ ਅਤੇ ਮੈਂ ਕਰਦੀ ਹਾਂ ਅਤੇ ਕਈ ਵਾਰੀ ਹੁੰਦਾ ਵੀ ਮੈਨੂੰ ਮਤਲਬ ਵੀ ਨਹੀਂ ਸਮਝ ਆਉਂਦੀ ਜਾਂ ਫਿਰ ਮੈਂ ਹੌਲੀ ਹੌਲੀ ਕਈ ਵਾਰ ਪੁੱਛਣਾ ਵੀ ਪੈਂਦਾ ਕਿਸੇ ਨੂੰ ਮੈਂ ਕਿਵੇਂ ਕਰਾਂ ਗਲਤੀ ਹੋ ਜਾਂਦੀ ਕਈ ਵਾਰੀ ਉਹਨੂੰ ਠੀਕ ਵੀ ਕਰਨਾ ਪੈਂਦਾ ਜੇ ਹੁਣ ਕੁੰਡਾ ਡਿੱਗ ਪਿਆ ਤਾਂ ਜੇ ਤਾਂ ਉਹ ਥੱਲੇ ਜ਼ਿਆਦਾ ਡਿੱਗ ਪਿਆ ਤਾਂ ਫਿਰ ਉਹਨੂੰ ਮਤਲਬ ਬੁਣਨਾ ਔਖਾ ਤਾਂ ਹੋ ਜਾਂਦਾ ਜ਼ਿਆਦਾ ਥੱਲੇ ਹੋਵੇ ਤਾਂ ਫਿਰ ਉਹਨੂੰ ਉਧੇੜਨਾ ਹੀ ਪੈਂਦਾ ਕਈ ਵਾਰੀ ਅਤੇ ਵਾ ਖਾਸ ਕਰਕੇ ਵੀ ਜਿਹੜਾ ਗਲਾ ਹੈ ਜੈਂਟਸ ਜਿਹੜੇ ਕੋਈ ਭਾਰੇ ਮਤਲਵ ਸਰੀਰ ਦੇ ਆ ਜੈਂਟਸ ਉਹਨਾਂ ਦਾ ਜਿਹੜਾ ਗਲਾ ਬਣਾਉਣਾ ਉਹ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਵੀ ਜੇ ਹੁਣ ਮਤਲਬ ਵੀ ਮੋਟਾ ਬੰਦਾ ਤਾਂ ਉਹਨੂੰ ਪਿੱਛੇ ਜਦੋਂ ਮੋਢਿਆਂ ਦੇ ਨਾਲ ਹੀ ਕਾਟ ਜਦੋਂ ਪਾਉਂਦੇ ਆ ਆਪਾਂ ਅਤੇ ਨਾਲ ਹੀ ਆਪਾਂ ਨੂੰ ਬੁਣਨਾ ਪੈਂਦਾ ਗਲਾ ਅਤੇ ਜੇ ਹੁਣ ਛੋਟੀ ਉਮਰ ਦੇ ਉਹਨਾਂ ਨੂੰ ਥੋੜ੍ਹਾ ਜਿਹਾ ਮਤਲਬ ਮੋਢਾ ਬੁਣ ਕੇ ਅਤੇ ਉਤੋਂ ਕਾਟ ਮਤਲਬ ਗਲਾ ਕੱਢਣਾ ਪੈਂਦਾ ਅਤੇ ਕਈ ਵਾਰੀ ਛੋਟਾ ਵੱਡਾ ਹੋ ਜਾਂਦਾ ਗਲਾ ਅਤੇ ਫਿਰ ਬੜੇ ਧਿਆਨ ਨਾਲ ਇਹ ਕੰਮ ਜਿਹੜਾ ਇਹ ਕਰਨਾ ਪੈਂਦਾ ਅਤੇ ਮਤਲਬ ਮੇਰੀ ਇਹੀ ਕੋਸ਼ਿਸ਼ ਰਹਿੰਦੀ ਹੈ ਵੀ ਮੈਂ ਸਹੀ ਕੰਮ ਕਰਾਂ ਅਤੇ ਜੋ ਵੀ ਜੇ ਹੁੰਦਾ ਵੀ ਗਲਤ ਤਾਂ ਮੈਂ ਮਤਲਬ ਉਹਨੂੰ ਉਧੇੜ ਕੇ ਠੀਕ ਕਰਦੀ ਆ ਵੀ ਜਿਹੜਾ ਵੇਖਣ ਨੂੰ ਸੋਹਣਾ ਲੱਗੇ ਜੇ ਕੋਈ ਹੁਣ ਕੋਈ ਮਤਲਬ ਬੁਣਤੀ ਹੈ ਕੋਈ ਔਖੀ ਹੈ ਆਪਾਂ ਔਖੀ ਬੁਣਤੀ ਪਾ ਲਈ ਦੀ ਹੈ ਉਹ ਕਈ ਵਾਰ ਜੇ ਕੁੰਡਾ ਡਿੱਗ ਪਵੇ ਤਾਂ ਫਿਰ ਉਹਨੂੰ ਕਈ ਵਾਰ ਉਧੇੜ ਕੇ ਵੀ ਸੈੱਟ ਕਰਨਾ ਪੈਂਦਾ ਅਤੇ ਕਈ ਵਾਰ ਉਵੇਂ ਜੇ ਕਰਾਂਗੇ ਤਾਂ ਸੋਹਣਾ ਨਹੀਂ ਲੱਗਦਾ ਹੋਲ ਪੈ ਜਾਂਦਾ ਕਈ ਵਾਰੀ ਕੁੰਡਾ ਚੱਕ ਕੇ ਅਤੇ ਇਹ ਸਾਡੀ ਕੋਸ਼ਿਸ਼ ਇਹ ਰਹਿੰਦੀ ਹੈ ਵੀ ਅਸੀਂ ਸਭ ਤੋਂ ਵਧੀਆ ਕੰਮ ਕਰੀਏ ਅਤੇ ਵੀ ਵੇਖਣ ਵਾਲੇ ਨੂੰ ਵੀ ਚੰਗਾ ਲੱਗੇ ਅਤੇ ਆਪ ਵੀ ਮਤਲਬ ਸੰਤੁਸ਼ਟ ਹੋ ਜਾਂਦੇ ਅਤੇ ਅਗਲਾ ਵੀ ਸੰਤੁਸ਼ਟ ਹੋਵੇ